ਇੱਕ ਵਾਰ ਦੀ ਗੱਲ ਹੈ ਜਦੋਂ ਮੈਂ ਆਪਣੀ ਦਸਵੀਂ ਜਮਾਤ ਵਿੱਚ ਹੁੰਦੀ ਸੀ ਉਸ ਵੇਲੇ ਸਾਡੇ ਸਕੂਲ ਵਾਲੇ ਸਾਨੂੰ ਮਨਾਲੀ ਲੈ ਕੇ ਗਏ ਸਨ ਅਤੇ ਸਾਨੂੰ ਹਾਈਕਿੰਗ ਵਾਸਤੇ ਉੱਥੇ ਇੱਕ ਜੰਗਲ ਵਿੱਚ ਲੈ ਕੇ ਗਏ ਸੀ ਉਸ ਸਵੇਰੇ ਉੱਥੇ ਬਹੁਤ ਜ਼ਿਆਦਾ ਮੀਂਹ ਪਿਆ ਸੀ ਅਤੇ ਬਹੁਤ ਜ਼ਿਆਦਾ ਫਿਸਲਣ ਵੀ ਹੋਈ ਪਈ ਸੀ ਹਾਈਕਿੰਗ ਦੇ ਦੌਰਾਨ ਮੇਰਾ ਧਿਆਨ ਪੂਰੀ ਤਰਾਂ ਨਾ ਹੋਣ ਦੇ ਕਾਰਨ ਪੈਰ ਫਿਸਲ ਗਿਆ ਅਤੇ ਮੈਂ ਬਹੁਤ ਹੀ ਜ਼ੋਰ ਦੀ ਥੱਲੇ ਡਿੱਗ ਗਈ ਜਿਸ ਕਰਕੇ ਮੇਰੇ ਦੋਨੋਂ ਹੀ ਗਿੱਟਿਆਂ 'ਤੇ ਸੱਟ ਲੱਗ ਗਈ ਪਰ ਮੇਰੇ ਝੋਲੇ ਵਿੱਚ ਪਹਿਲਾਂ ਤੋਂ ਹੀ ਦਵਾਈਆਂ ਦਾ ਡੱਬਾ ਸੀ ਜੋ ਸਾਡੇ ਸਕੂਲ ਅਧਿਆਪਕ ਨੇ ਸਾਨੂੰ ਸਾਡੇ ਕੋਲ ਰੱਖਣ ਲਈ ਕਿਹਾ ਸੀ ਜਿਸਦੀ ਸਹਾਈਤਾ ਨਾਲ ਮੈਂ ਆਪਣੇ ਦੋਨੋਂ ਜਖ਼ਮਾਂ 'ਤੇ ਐਂਟੀਸੈਪਟਿਕ ਕਰੀਮ ਲਗਾਈ ਅਤੇ ਫਿਰ ਪੱਟੀ ਕਰ ਲਈ ਪਰ ਅੱਗੇ ਦਾ ਸਫ਼ਰ ਮੇਰੇ ਲਈ ਬਹੁਤ ਹੀ ਜ਼ਿਆਦਾ ਮੁਸ਼ਕਿਲ ਰਿਹਾ ਕਿਉਂਕਿ ਜ਼ਖਮਾ ਕਰਕੇ ਮੈਨੂੰ ਬਹੁਤ ਦਰਦ ਹੋ ਰਿਹਾ ਸੀ ਪਰ ਮੇਰੇ ਮਿੱਤਰਾਂ ਨੇ ਮੇਰਾ ਬਹੁਤ ਹੀ ਮਦਦ ਕੀਤੀ ਉਹਨਾਂ ਵਿੱਚੋਂ ਇੱਕ ਨੇ ਮੇਰੇ ਝੋਲੇ ਨੂੰ ਫੜ ਲਿਆ ਅਤੇ ਦੂਸਰੇ ਨੇ ਮੈਨੂੰ ਸਹਾਰਾ ਦੇ ਦਿੱਤਾ ਜਿਹਦੇ ਕਰ ਕੇ ਮੈਂ ਕਿਸੀ ਤਰ੍ਹਾਂ ਆਪਣੀ ਟਰੈਕਿੰਗ ਪੂਰੀ ਕਰ ਲਈ